ਹਾਂਜੀ ਤੁਸੀਂ ਰੋਹਨ ਸਟੇਸ਼ਨਰੀ ਤੋਂ ਬੋਲਦੇ ਪਏ ਅੱਛਾ ਮੈਨੂੰ ਨਾ ਮੇਰੀ ਫਰੈਂਡ ਨੇ ਨੰਬਰ ਦਿੱਤਾ ਸੀ ਤੁਹਾਡਾ ਕਿ ਨਾ ਤੁਹਾਡੀ ਮਤਲਬ ਦੁਕਾਨ 'ਤੇ ਮਤਲਬ ਸ਼ੋਪ 'ਤੇ ਨਾ ਪੈੱਨ ਪੈਨਸਲ ਸਟੇਸ਼ਨਰੀ ਬੁੱਕ ਮਤਲਬ ਚੰਗੀ ਕੁਆਲਿਟੀ ਦੇ ਮਿਲਦੇ ਆ ਹਾਂਜੀ ਜੀ ਤੁਹਾਡੀ ਦੁਕਾਨ 'ਤੇ ਕੋਪੀਆਂ ਦੇ ਰੇਟ ਮਤਲਬ ਕਿੰਨੇ ਕਿੰਨੇ ਤੋਂ ਕਿੰਨੇ ਤੱਕ ਦੇ ਆ ਪੈਨਸਲ ਪ ਪੈਨਸਲ ਪੈੱਨ ਅੱਛਾ ਪੈੱਨ ਕਿਹੜੀ ਕਿਹੜੀ ਕੁਆਲਿਟੀ ਦੇ ਹੈ ਅੱਛਾ ਅੱਛਾ ਅੱਛਾ ਠੀਕ ਹੈ ਮੈਂ ਹੁਣ ਤਾਂ ਮੈਨੂੰ ਤੁਹਾਡਾ ਨੰਬਰ ਮਿਲ ਗਿਆ ਮੈਂ ਨਾ ਤੁਹਾਨੂੰ ਲਿਸਟ ਬਣਾ ਕੇ ਭੇਜਦੂੰਗੀ ਠੀਕ ਹੈ ਤੁਸੀਂ ਨਾ ਮੈਨੂੰ ਜਿਹੜੀ ਵੀ ਮੈਨੂੰ ਕੋਪੀ ਚਾਹੀਦੀ ਪੈਨਸਲ ਚਾਹੀਦੀ ਪੈੱਨ ਚਾਹੀਦਾ ਮੈਂ ਤੁਹਾਨੂੰ ਸਾਰੀਆਂ ਦੀ ਲਿਸਟ ਬਣਾ ਕੇ ਦੇ ਦੂੰਗੀ ਤੁਸੀਂ ਮੈਨੂੰ ਨਾ ਮਤਲਬ ਰੇਟ ਸਹੀ ਸਹੀ ਲਾ ਕੇ ਤੁਸੀਂ ਮੈਨੂੰ ਨਾ ਭੇਜ ਦਿਓ ਅਤੇ ਮੈਂ ਤੁਹਾਨੂੰ ਬਿੱਲ ਦੇ ਦੂੰਗੀ ਠੀਕ ਹੈ ਮੈਂ ਤੁਹਾਡੇ ਬਾਰੇ ਬਹੁਤ ਕੁਛ ਸੁਣਿਆ ਮੈਂ ਤੁਹਾਡੇ ਬਾਰੇ ਬਹੁਤ ਕੁਛ ਸੁਣਿਆ ਕਿ ਮੈਂ ਤੁਹਾਡੀ ਦੁਕਾਨ 'ਤੇ ਬਹੁਤ ਸਾਮਾਨ ਮਤਲਬ ਸਹੀ ਮਤਲਬ ਮਿਲਦੇ ਆ ਤੁਹਾਡੀ ਕੁਆਲਿਟੀ ਬਹੁਤ ਚੰਗੀ ਹੈ ਅੱਛਾ ਨਹੀਂ ਤੁਹਾਡਾ ਅਡਰੈੱਸ ਮੈਨੂੰ ਦੱਸ ਦੋਂਗੇ ਠੀਕ ਹੈ ਤੁਹਾਡੇ ਕੋਲ ਕਲਾਸਮੇਟ ਕੰਪਨੀ ਦਾ ਰਜਿਸਟਰ ਹੈ ਕਲਾਸਮੇਟ ਕੰਪਨੀ ਅੱਛਾ ਅੱਛਾ ਠੀਕ ਹੈ ਮੈਂ ਤੁਹਾਨੂੰ ਦੱਸ ਦੂੰਗੀ ਮੈਨੂੰ ਨਾ ਕੀ ਕੀ ਚਾਹੀਦਾ ਮੈਂ ਤੁਹਾਨੂੰ ਸੈਂਡ ਕਰ ਦੂਗੀ ਮੈਸੇਜ ਕਰਕੇ ਕੀ ਕੀ ਚਾਹੀਦਾ ਤੁ ਤੁਸੀਂ ਮੈਨੂੰ ਭੇਜ ਦਿਓ ਠੀਕ ਹੈ ਠੀਕ ਹੈ ਅੱਛਾ ਠੀਕ ਹੈ ਠੀਕ ਹੈ ਥੈਂਕ ਯੂ ਓਕੇ ਓਕੇ ਓਕੇ ਓਕੇ